ਮੇਰੀ ਇੱਕ ਛੋਟੀ ਭੈਣ ਹੈ ਜੇ ਆਪਾਂ ਸਮਾਨ ਜਾਂ ਵੱਖਰੇ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਜ਼ਿਆਦਾ ਖਰਚੀਲੀ ਹੈ ਬਹੁਤ ਸਾਰੇ ਛੋਟੇ ਛੋਟੇ ਖਰਚਿਆਂ ਉਹ ਆਰਾਮ ਨਾਲ ਕਰ ਦਿੰਦੀ ਹੈ ਪਰ ਮੈਂ ਥੋੜ੍ਹਾ ਜਿਹਾ ਘੱਟ ਖਰਚੀਲਾ ਹਾਂ ਇਸ ਤੋਂ ਇਲਾਵਾ ਉਹਨੂੰ ਜ਼ਿਆਦਾ ਘੁੰਮਣਾ ਪਸੰਦ ਹੈ ਮੈਂ ਜ਼ਿਆਦਾ ਘੁੰਮਣਾ ਪਸੰਦ ਨਹੀਂ ਕਰਦਾ